ਟੈਕਨੋਲਜੀ ਨੇ ਟਰਾਂਸਪੋਟੇਸ਼ਨ ਨੂੰ ਆਸਾਨ ਬਣਾਉਣ ਵਿੱਚ ਬਹੁਤ ਮਦਦ ਕੀਤੀ ਹੈ ਜਿਵੇਂ ਅਸੀਂ ਘਰ ਬੈਠੇ ਹੀ ਟਿਕੇਟ ਬੁਕਿੰਗ ਕਰਾ ਸਕਦੇ ਹਾਂ ਅਤੇ ਸਾਨੂੰ ਆਸਾਨੀ ਨਾਲ ਪਲੇਟਫਾਰਮ ਨੰਬਰ ਦਾ ਵੀ ਪਤਾ ਚੱਲ ਜਾਂਦਾ ਹੈ ਅਤੇ ਕਿਸੇ ਹੋਟਲ ਦੀ ਬੁਕਿੰਗ ਕਰਵਾਉਣੀ ਹੋਵੇ ਉਹ ਵੀ ਅਸੀਂ ਬਹੁਤ ਆਸਾਨੀ ਨਾਲ ਕਰਾ ਲੈਂਦੇ ਹਾਂ ਤੇ ਸਮੇਂ 'ਤੇ ਆਪਾਂ ਪਹੁੰਚ ਵੀ ਸਕਦੇ ਹਾਂ ਤੇ ਕਿਤੇ ਦਾ ਹਾ ਉਹਦਾ ਮੌਸਮ ਦਾ ਹਾਲ ਪਤਾ ਕਰਨਾ ਹੋਵੇ ਅਸੀਂ ਯਾਤਰਾ ਵਗੈਰਾ 'ਤੇ ਜਾਣਾ ਹੈ ਤਾਂ ਉਹ ਵੀ ਸਾਨੂੰ ਬੜੀ ਆਸਾਨੀ ਨਾਲ ਪਤਾ ਚੱਲ ਜਾਂਦਾ ਹੈ ਵੀ ਅਸੀਂ ਕਿਸ ਉੱਥੇ ਤਾਂ ਮੌਸਮ ਕਿੱਦਾਂ ਦਾ ਹੈ ਤੇ ਕਿਸ ਤਰ੍ਹਾਂ ਅਸੀਂ ਕਿਹੜੇ ਟਾਈਮ ਇੱਥੋਂ ਚੱਲਣਾ ਹੈ ਤੇ ਇਹ ਜਿਹੜੀ ਟੈਕਨੋਲਜੀ ਹੈ ਇਸਨੇ ਹਰ ਇੱਕ ਦੇ ਜੀਵਨ ਨੂੰ ਬਹੁਤ ਹੀ ਆਸਾਨ ਬਣਾ ਦਿੱਤਾ ਹੈ